ਪੰਜਾਬ ਦੇ ਵਿੱਚ ਸੱਭਿਆਚਾਰਕ ਪਾੜੇ ਨੂੰ ਦੂਰ ਕਰਨ ਦੇ ਲਈ ਅਤੇ ਲੋਕਾਂ ਨੂੰ ਇਕੱਠ ਕਰਨ ਦੇ ਲਈ ਡਾਂਸ ਬਹੁਤ ਹੀ ਫਾਇਦੇਮੰਦ ਹੈ ਪੰਜਾਬ ਦੇ ਲੋਕ ਨਾਚ ਜਿਵੇਂ ਭੰਗੜਾ ਗਿੱਧਾ ਅਜਿਹੇ ਨਾਚ ਹਨ ਜੋ ਲੋਕਾਂ ਦੇ ਵਿੱਚ ਜੋਸ਼ ਪੈਦਾ ਕਰਦੇ ਹਨ ਅਤੇ ਲੋਕਾਂ ਨੂੰ ਨੱਚਣ 'ਤੇ ਮਜਬੂਰ ਕਰ ਦਿੰਦੇ ਹਨ ਅਤੇ ਉਹਨਾਂ ਦਾ ਇਕੱਠ ਵੀ ਕਰ ਦਿੰਦੇ ਹਨ